ਦੁਨੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਦੇਸ਼ ਨੇ ਹਰ ਇੱਕ ਦੇਸ਼ ਦਾ ਆਪਣਾ ਆਪਣਾ ਸੱਭਿਆਚਾਰ ਹੈ ਆਪਣੀ ਆਪਣੀ ਸਮਾਜਿਕ ਯੋਗਦਾਨ ਨੇ ਅਤੇ ਉਸ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਹੈ ਸਾਡੇ ਵੱਖ ਵੱਖ ਪ੍ਰਾਂਤ ਨੇ ਔਰ ਵੱਖ ਵੱਖ ਸੱਭਿਆਚਾਰ ਨੇ ਹਰ ਇੱਕ ਦਾ ਜਿਹੜਾ ਸੱਭਿਆਚਾਰ ਹੈ ਉਹ ਵੱਖਰਾ ਹੈ ਉਸ ਪੰ ਇਸ ਦੇ ਵਿੱਚ ਜਿਹੜਾ ਪੰਜਾਬ ਏ ਪੰਜਾਬ ਦੇ ਵਿੱਚ ਜਿਹੜਾ ਉਸਦਾ ਆਪਣਾ ਹੀ ਵੱਖਰਾ ਸੱਭਿਆਚਾਰਕ ਯੋਗਦਾਨ ਹੈਗਾ ਸਮਾਜਿਕ ਯੋਗਦਾਨ ਹੈ ਅਤੇ ਇਸ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਇੱਕ ਬਹੁਤ ਹੀ ਵਧੀਆ ਰੋਲ ਪਲੇ ਕਰਦਾ ਏ ਗੁਰੂ ਗ੍ਰੰਥ ਸਾਹਿਬ ਦੇ ਤਾਂ ਪੁੱਛ ਰਹੇ ਉਹਦੇ ਵਿੱਚ ਪਰਮਾਤਮਾ ਦੀ ਉਸਤਤੀ ਕੀਤੀ ਗਈ ਦਸ ਗੁਰੂ ਸਾਹਿਬਾਨਾਂ ਦਾ ਜਿਹੜਾ ਉਹ ਛੇ ਗੁਰੂ ਸਾਹਿਬਾਨ ਜਿਹੜੇ ਹੈ ਉਹਨਾਂ ਦੀ ਬਾਣੀ ਦਰਜ ਹੈ ਭਗਤਾਂ ਦੀ ਬਾਣੀ ਹੈ ਭੱਟਾਂ ਦੀ ਬਾਣੀ ਹੈ ਉਹਨਾਂ ਨੇ ਜਿਹੜਾ ਪਰਮਾਤਮਾ ਦੀ ਉਸਤਤੀ ਕੀਤੀ ਹੋਈ ਹੈ ਇਸ ਦੇ ਵਿੱਚ ਜਿਹੜਾ ਹੈ ਸਮਾਜਿਕ ਜਿਹੜੀ ਸਮਾਨਤਾ ਦੀ ਵੀ ਗੱਲ ਕੀਤੀ ਗਈ ਹੈ ਔਰਤ ਨੂੰ ਬਰਾਬਰਤਾ ਦੇਣ ਦਾ ਵੀ ਜਿਹੜਾ ਹੈ ਉਸ ਦਿੱਤਾ ਹੋਇਆ ਕਿਆ ਹੋਇਆ ਕਿ ਕਿਹਾ ਗਿਆ ਸ ਮਤਲਬ ਜਿਹੜੀ ਸਮਾਜਿਕ ਜਿਹੜੀਆਂ ਕੁਰੀਤੀਆਂ ਸੀਗੀਆਂ ਸਤੀ ਪ੍ਰਥਾ ਵਗੈਰਾ ਜਾਂ ਪਰਦਾ ਪ੍ਰਥਾ ਜੋ ਵੀ ਸੀਗਾ ਉਹਦੇ ਬਾਰੇ ਵੀ ਇਸਦੇ ਵਿੱਚ ਜਿਹੜਾ ਉਸਦਾ ਵਿਰੋਧ ਕੀਤਾ ਗਿਆ ਹੈ ਔਰਤ ਨੂੰ ਇੱਕ ਬਰਾਬਰ ਦਰਜੇ 'ਤੇ ਲਿਆਉਣ ਦੀ ਗੱਲ ਕੀਤੀ ਗਈ ਹੈ ਸੋ ਇਹਦੇ ਵਿੱਚ ਸੰਗੀਤ ਜਿਹੜਾ ਹੈ ਸੰ ਸੰਗੀਤ ਜਿਹੜਾ ਸਾਡੇ ਸੰਗੀਤ ਤ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਸੰਗੀਤ ਦੇ ਰਾਹੀਂ ਜਿਹੜਾ ਪਰਮਾਤਮਾ ਨੂੰ ਜਿਹੜਾ ਹੈ ਧਿਆਇਆ ਜਾਂਦਾ ਹੈ ਅਤੇ ਸੰ ਇਸ ਵਿੱਚ ਹੈ ਅਲੱਗ ਅਲੱਗ ਇੱਕਤੀ ਰਾਗ ਨੇ ਹਰ ਇੱਕ ਰਾਗ ਦੀ ਆਪਣੀ ਵਿਸ਼ੇਸ਼ਤਾ ਹੈ ਅਤੇ ਰਾਗਾਂ ਦੇ ਵਿੱਚ ਜਿਹੜਾ ਹੈ ਪਰਮਾਤਮਾ ਦਾ ਗਾਇਨ ਕੀਤਾ ਜਾਂਦਾ ਅਤੇ ਸਾਡੀ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਗੀ ਜਿਹੜੇ ਹੈ ਉਹ ਮਸ਼ਹੂਰ ਜਿਹੜੇ ਰਾਗੀ ਆ ਉਹ ਇਸ ਦੇ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਹਨ